ਮੈਂ ਆਮ ਤੌਰ 'ਤੇ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਹੀ ਖਿੱਚਦਾ ਜਿਵੇਂ ਕਿ ਜਾਨਵਰ ਅਤੇ ਹੋਰ ਪਸ਼ੂ ਪਕਸ਼ੀ ਅਤੇ ਪਹਾੜ ਅਤੇ ਹੋਰ ਤੇਰੀ